ਹੈਲੋ ਹਾਂਜੀ ਮੈਮ ਗੁਡ ਆਫਟਰਨੂਨ ਮੈਮ ਹਾਂਜੀ ਮੈਮ ਹਾਂਜੀ ਹਾਂਜੀ

ਹਾਂਜੀ ਮੈਮ ਸਾਡੇ ਕੋਲ ਸਾਰੀਆਂ ਖੇਡਾਂ ਉਪਲੱਬਧ ਨੇ ਜਿਵੇਂ ਕਿ ਫੁੱਟਬਾਲ ਹੋ ਗਿਆ ਬੋਲੀਬਾਲ ਹੋ ਗਿਆ ਕਬੱਡੀ ਆ ਸਾਰੀਆਂ ਖੇਡਾਂ ਸਾਡੇ ਕੋਲ ਉਪਲੱਬਧ ਹੈਗੀਆਂ ਤੁਸੀਂ ਕਿਹੜੀ ਖੇਡ 'ਚ ਇੰਟਰਸਟ ਹੈਗੇ ਹੋ

ਹਾਂਜੀ ਹਾ ਹਾਂਜੀ ਮੈਮ ਸਾਰੇ ਪ੍ਰਬੰਧ ਹੈਗੇ ਨੇ ਜਿਹੜੀ ਖੇਡ 'ਚ ਇੰਟਰਸਟ ਹੈਗਾ ਵਾ ਉਸ ਖੇਡ 'ਚ ਰੱਖਿਆ ਜਾਊਗਾ ਸਾਡੇ ਕੋਲ ਮਤਲਬ ਖੇਡਣ ਵਾਸਤੇ ਕਿੱਟ ਵੀ ਅਸੀਂ ਖੁਦ ਦਿੰਦੇ ਹੈਗੇ ਆ ਅਤੇ ਪਾਣੀ ਪਿਉਣ ਵਾਸਤੇ ਠੰਡਾ ਪਾਣੀ ਵੀ ਅਸੀਂ ਖੁਦ ਦਿੰਦੇ ਹੈਗੇ ਜਿੰਨਾ ਚਿਰ ਮਤਲਬ ਇੱਥੇ ਰਹਿਣਗੇ ਉੰਨਾ ਚਿਰ ਅਸੀਂ ਉਹਨਾਂ ਦੀ ਕੇਅਰ ਖੁਦ ਕਰਾਂਗੇ ਅਤੇ ਤੁਹਾਨੂੰ ਕੋਈ ਵੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ ਭੇਜ ਸਕਦੇ ਹੋ ਮੰਥਨੀ ਤਾਂ ਮੈਮ ਸਾਡੀ ਹੈਗੀ ਆ ਛੇ ਹਜ਼ਾਰ ਹੈਗੀ ਆ ਜੀ ਟਾਈਮਿੰਗ ਮੈਮ ਹੈਗੀ ਆ ਸ਼ਾਮ ਨੂੰ ਚਾਰ ਵਜੇ ਤੋਂ ਛੇ ਵਜੇ ਤੋਂ ਲੈ ਕੇ ਅਸੀਂ ਖਿਡਾਉਂਦੇ ਹਾਂ ਹਾਂਜੀ ਬੋਲੋ ਹਾਂਜੀ ਹਾਂਜੀ ਮੈਮ ਟਾਈਮ ਟੂ ਟਾਈਮ ਵਧੀਆ ਖੇਡਾਂ ਹੋਣਗੀਆਂ ਤੁਸੀਂ ਕੋਈ ਗੱਲ ਟਾਈਮ 'ਤੇ ਮਤਲਬ ਚਾਰ ਵਜੇ ਆਇਆ ਕਰਨਗੇ ਛੇ ਵਜੇ ਤੱਕ ਖਿਡਾਇਆ ਕਰਾਂਗੇ ਉਹਨਾਂ ਨੂੰ ਵਧੀਆ ਮਤਲਬ ਵਧੀਆ ਤਰੀਕੇ ਨਾਲ ਖਿਡਾਇਆ ਜਾਊ ਜਿਵੇਂ ਉਹਨਾਂ ਦੀ ਜਿਹੜੀ ਖੇਡ 'ਚ ਉਹਨਾਂ ਦੀ ਰੁਚੀ ਹੋਵੇਗੀ ਉਸ ਖੇਡ 'ਚ ਉਹਨਾਂ ਨੂੰ ਖਿਡਾਇਆ ਜਾਊਗਾ ਅਤੇ ਮਤਲਬ ਮੰਥਨੀ ਫੀਸ ਤੁਹਾਨੂੰ ਦੱਸ ਦਿੱਤੀ ਗਈ ਆ ਟਾਈਮਿੰਗ ਦੱਸ ਦਿੱਤਾ ਗਿਆ ਬਾਕੀ ਤੁਸੀਂ ਜਿਹੜੇ ਟਾਈਮ ਮਰਜ਼ੀ ਆ ਕੇ ਖੁਦ ਵੀ ਆ ਕੇ ਇੱਥੇ ਗਰਾਉਂਡ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਸਾਰੀਆਂ ਸੁਵਿਧਾ ਉਪਲੱਬਧ ਹੈਗੀਆਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਅਤੇ ਘਬਰਾਉਣ ਵਾਲੀ ਗੱਲ ਹੈ ਨਹੀਂ ਓ ਓਕੇ ਜੀ ਥੈਂਕ ਯੂ ਮੈਮ ਥੈਂਕ ਯੂ